ਪਿੰਡਾਂ ਦੇ ਬਜ਼ੁਰਗ ਬਹੁਤ ਸਾਰੀਆਂ ਖੇਡਾਂ ਖੇਡਦੇ ਹਨ ਸਾਡੇ ਪਿੰਡ ਦੇ ਬਜ਼ੁਰਗ ਸੱਥ ਵਿੱਚ ਬੈਠ ਕੇ ਤਾਸ਼ ਖੇਡਣਾ ਜ਼ਿਆਦਾ ਪਸੰਦ ਕਰਦੇ ਹਨ ਉਹ ਤਾਸ਼ ਵਿੱਚ ਭਾਬੀ ਦਿਓਰ ਸੀਪ ਚੌਸਰ ਤਿੰਨ ਤੋਂ ਪੰਜ ਖੇਡਦੇ ਨੇ ਸਾਡੇ ਪਿੰਡ ਦੇ ਵਿੱਚ ਇਹਨਾਂ ਦੇ ਟੂਰਨਾਮੈਂਟ ਵੀ ਕਰਾਏ ਜਾਂਦੇ ਹਨ ਸਾਡੇ ਪਿੰਡ ਵਿੱਚ ਜਦੋਂ ਵੀ ਕੋਈ ਟੂਰਨਾਮੈਂਟ ਹੁੰਦਾ ਹੈ ਤਾਂ ਉਸਦੇ ਵਿੱਚ ਬਜ਼ੁਰਗਾਂ ਜਾਂ ਬਜ਼ੁਰਗਾਂ ਦੀਆਂ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ ਜਿਵੇਂ ਬਲਦ ਦੜਾਉਣਾ ਬਜ਼ੁਰਗਾਂ ਦੀਆਂ ਦੌੜਾਂ ਕੁੱਕੜ ਫੜਨਾ ਅਤੇ ਬਜ਼ੁਰਗਾਂ ਦੀ ਕਬੱਡੀਆਂ ਦੇ ਮੈਚ ਵੀ ਕਰਵਾਇਆ ਜਾਂਦਾ ਹੈ ਅੱਜ ਕੱਲ੍ਹ ਪਿੰਡਾਂ ਵਿੱਚ ਬਜ਼ੁਰਗਾਂ ਲਈ ਤਾਸ਼ ਦਾ ਟੂਰਨਾਮੈਂਟ ਵੀ ਕਰਵਾਇਆ ਜਾਂਦਾ ਹੈ ਇਸ ਵਿੱਚ ਇਹਨਾਂ ਨੂੰ ਵਧੀਆ ਇਨਾਮ ਵੀ ਦਿੱਤਾ ਜਾਂਦਾ ਹੈ ਕੁੱਕੜ ਫੜਣ ਦੇ ਮੁਕਾਬਲੇ ਵਿੱਚ ਜਦੋਂ ਕੋਈ ਵੀ ਬਜ਼ੁਰਗ ਕੁੱਕੜ ਨੂੰ ਫੜ ਲੈਂਦਾ ਹੈ ਤਾਂ ਉਹ ਕੁੱਕੜ ਉਸਦਾ ਹੋ ਜਾਂਦਾ ਹੈ